ਭਾਰਤੀ ਸਿਹਤ ਸੰਭਾਲ ਪ੍ਰਣਾਲੀ ਦੇ ਵਿੱਚ ਪਹਿਲਾਂ ਨਾਲੋਂ ਕੁਝ ਸੁਧਾਰ ਜ਼ਰੂਰ ਆਏ ਨੇ ਪਰ ਫਿਰ ਵੀ ਜਿਹੜੇ ਲੋਕ ਨੇ ਓਹਨਾਂ ਨੂੰ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਦਵਾਈਆਂ ਬਹੁਤ ਮਹਿੰਗੀਆਂ ਨੇ ਇਲਾਜ ਬਹੁਤ ਮਹਿੰਗੇ ਨੇ ਬਿਨਾਂ ਸ਼ੱਕ ਕੁਝ ਸਹੂਲਤਾਂ ਜਾਂ ਸਕੀਮਾਂ ਜਿਹੜੀਆਂ ਨੇ ਉਹ ਸਰਕਾਰ ਵੱਲੋਂ ਚਲਾਈਆ ਗਈਆਂ ਨੇ ਪਰ ਉਹਨਾਂ ਦੇ ਤਹਿਤ ਵੀ ਲੋਕਾਂ ਨੂੰ ਬੜੀਆਂ ਬੜੀਆਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣਾ ਪੈਂਦਾ ਅਤੇ ਕਈ ਵਾਰੀ ਲੋਕਾਂ ਦਾ ਉਹਨਾਂ ਸੰਸਥਾਵਾਂ ਤੋਂ ਜਿਹੜੀਆਂ ਦਵਾਈਆਂ ਮਿਲਦੀਆਂ ਨੇ ਉਹਨਾਂ 'ਤੇ ਵਿਸ਼ਵਾਸ਼ ਨਹੀਂ ਬਣਦਾ ਉਹਨਾਂ ਨੂੰ ਲੱਗਦਾ ਸ਼ਾਇਦ ਇਹ ਉਸ ਤਰ੍ਹਾਂ ਅਸਰ ਨਹੀਂ ਕਰਦੀਆਂ ਜਾਂ ਇਹ ਨਕਲੀ ਦਵਾਈਆਂ ਹੋ ਸਕਦੀਆਂ ਨੇ ਅਤੇ ਕੁਝ ਸਕੀਮਾਂ ਦੇ ਤਹਿਤ ਵੀ ਜਿਵੇਂ ਕੁਛ ਗਰੀਬ ਲੋਕ ਹੁੰਦੇ ਨੇ ਉਹਨਾਂ ਨੂੰ ਫਰੀ ਕੋਈ ਓਪਰੇਸ਼ਨ ਜਾਂ ਦਵਾਈਆਂ ਦਾ ਜਿਹੜਾ ਸਹੂਲਤ ਦਿੱਤੀ ਗਈ ਹੈ ਤਾਂ ਜਦੋਂ ਉਹ ਡੋਕਟਰ ਕੋਲ ਜਾਂਦੇ ਨੇ ਜਿਵੇਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਉਹ ਸਕੀਮਾਂ ਲਾਗੂ ਹੋ ਜਾਂਦੀਆਂ ਨੇ ਤਾਂ ਡੋਕਟਰ ਓਹਨਾਂ ਦੇ ਜਿਹੜੇ ਐਕਸਰੇ ਨੇ ਜਾਂ ਬਲੱਡ ਟੈਸਟ ਨੇ ਜਾਂ ਕੋਈ ਅਲਟ੍ਰਾਸਾਊਂਡ ਨੇ ਉਹ ਬਾਹਰੋਂ ਕਰਵਾਉਣ ਨੂੰ ਕਹਿ ਦਿੰਦੇ ਨੇ ਉੱਥੇ ਮਰੀਜ਼ ਆਪਣੇ ਪੈਸੇ ਖਰਚਣੇ ਖਰਚਦੇ ਨੇ ਦਸ ਦਸ ਵੀਹ ਵੀਹ ਹਜ਼ਾਰ ਰੁਪਏ ਪਰ ਜਦੋਂ ਔਨਲਾਈਨ ਬਿੱਲ ਬਣ ਕੇ ਜਾਂਦਾ ਉਹਨਾਂ ਦੇ ਐਕਸਰਿਆਂ ਨੂੰ ਅਲਟ੍ਰਾਸਾਊਂਡ ਨੂੰ ਡੋਕਟਰ ਜਿਹੜੇ ਨੇ ਆਪਣੇ ਹਿੱਸੇ ਪਾ ਲੈਂਦੇ ਨੇ ਮਤਲਬ ਇੱਕ ਤਰ੍ਹਾਂ ਨਾਲ ਇਹ ਉਹਨਾਂ ਦੀ ਕਮਾਈ ਦਾ ਸਾਧਨ ਵੀ ਬਣ ਗਈਆਂ ਇਹ ਸਕੀਮਾਂ ਜਿਹੜੀਆਂ ਨੇ ਅਤੇ ਇਸ ਪ੍ਰਕਾਰ ਬਿਨਾਂ ਸ਼ੱਕ ਭਾਰਤੀ ਸਿਹਤ ਸੰਭਾਲ ਪ੍ਰਣਾਲੀ ਜਿਹੜੀ ਹੈ ਉਹਦੇ 'ਚ ਸਮੇਂ ਸਮੇਂ ਕੁਝ ਸੁਧਾਰ ਵੀ ਆਉਂਦੇ ਨੇ ਪਰ ਉਹਨਾਂ ਸੁਧਾਰਾਂ ਦੇ ਬਾਵਜੂਦ ਲੋਕਾਂ ਨੂੰ ਬੜੀਆਂ ਚੁਣੌਤੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ